ਜੇ ਮੇਰੇ ਪਿੰਡ ਦੇ ਕਿਸੇ ਵਿਅਕਤੀ ਨੂੰ ਕੁੱਤਾ ਕੱਟ ਲਵੇ ਤਾਂ ਪਹਿਲਾਂ ਮੈਂ ਉਹਦਾ ਜ਼ਖਮ ਦੇਖੂੰਗੀ ਮੈਂ ਦੇਖੂੰਗੀ ਕਿ ਜ਼ਖਮ ਕਿੰਨਾਂ ਗਹਿਰਾ ਹੈ ਅਗਰ ਜ਼ਖਮ ਘੱਟ ਗਹਿਰਾ ਹੈ ਤਾਂ ਮੈਂ ਉਸ ਵੇਲੇ ਐਂਟੀਸੈਪਟਿਕ ਲਿਕੁਅਡ ਲਗਾ ਕੇ ਉਸ ਵਿਅਕਤੀ ਦੇ ਪੱਟੀ ਬੰਨਾਂਗੀ ਅਤੇ ਮੈਂ ਵਿਅਕਤੀ ਦੇ ਘਰਦਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਵਾਂਗੀ ਅਗਰ ਜ਼ਖਮ ਜ਼ਿਆਦਾ ਡੂੰਘਾ ਹੈ ਮੈਂ ਉਹਦੀ ਮੁੱਢਲੀ ਸਹਾਇਤਾ ਦੇ ਕੇ ਉਹਨੂੰ ਕਾਰ ਵਿੱਚ ਬਿਠਾ ਕੇ ਹਸਪਤਾਲ ਲੈ ਜਾਵਾਂਗੀ ਅਤੇ ਉੱਥੇ ਇਲਾਜ ਕਰਾਵਾਂਗੀ ਇਸ ਤੋਂ ਬਾਅਦ ਮੈਂ ਉਸ ਕੁੱਤੇ ਬਾਰੇ ਪੈੱਟ ਕੰਟਰੋਲ ਵਾਲਿਆਂ ਨੂੰ ਜਾਣਕਾਰੀ ਦੇਵਾਂਗੀ ਕਿ ਇਹ ਕੁੱਤਾ ਕਿਸ ਰੰਗ ਦਾ ਹੈ ਅਤੇ ਇਹ ਹਲਕ ਚੁੱਕਿਆ ਹੈ ਇਸ ਨੂੰ ਜਲਦੀ ਤੋਂ ਜਲਦੀ ਇਲਾਕੇ ਵਿੱਚੋਂ ਕੱਢਿਆ ਜਾਵੇ ਜਾਂ ਇਸ ਨੂੰ ਪਕੜ ਕੇ ਲੈ ਜਾਣ ਅਤੇ ਇਸ ਨੂੰ ਇਸ ਪਿੰਡ ਵਿੱਚੋਂ ਕੱਢ ਦਿੱਤਾ ਜਾਵੇ